ਵੈਸੇ ਤਾਂ ਮੈਂ ਅਕਸਰ ਜਿਮ ਵਿੱਚ ਜੋ ਦੌੜਨ ਲਈ ਇੱਕ ਸਪੈਸ਼ਲ ਮਸ਼ੀਨ ਹੁੰਦੀ ਹੈ ਉਸ ਉੱਪਰ ਦੌੜ ਉਸ ਉੱਪਰ ਹੀ ਦੌੜਦਾ ਹਾਂ ਕਿਉਂਕਿ ਸਾਡੇ ਆਸ ਪਾਸ ਦੇ ਏਰੀਏ ਵਿੱਚ ਕੋਈ ਗਰਾਊਂਡ ਨਹੀਂ ਹੈ ਪਰ ਇੱਕ ਵਾਰੀ ਮੈਂ ਤੁਹਾਡੇ ਨਾਲ ਇੱਕ ਕਿੱਸਾ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਗਰਮੀਆਂ ਦੇ ਦਿਨ ਸੀ ਤਾਂ ਮੈਂ ਆਪਣੇ ਮਿੱਤਰਾਂ ਨਾਲ ਜਾਂਦਾ ਹੁੰਦਾ ਸੀ ਸੈਰ ਕਰਨ ਹਲਕੀ ਹਲਕੀ ਵੋਕ ਅਸੀਂ ਕਰਦੇ ਦੋ ਤਿੰਨ ਕਿਲੋਮੀਟਰ ਦੀ ਤਾਂ ਉੱਥੇ ਕੀ ਹੋਇਆ ਕਿ ਮੇਰੇ ਜਿਹੜੇ ਦੋਸਤ ਨੇ ਉਹ ਥੋੜ੍ਹੇ ਜਿਹੇ ਸ਼ਰਾਰਤੀ ਨੇ ਅਸੀਂ ਗਰਾਊਂਡ ਦੇ ਵਿੱਚ ਇੱਕ ਗਰਾਊਂਡ ਹੈਗਾ ਸਾਡੇ ਇੱਥੇ ਅਤੇ ਅਸੀਂ ਚੱਕਰ ਲਾ ਚੱਕਰ ਲਾਉਂਦੇ ਸੀ ਉਹਦੇ ਵਿੱਚ ਗਰਾਊਂਡ ਕਾਫ਼ੀ ਵੱਡਾ ਸੀਗਾ ਤਾਂ ਉੱਥੇ ਦੋ ਤਿੰਨ ਜਿਹੜੇ ਜਾਨਵਰ ਸੀ ਕੁੱਤੇ ਸੀਗੇ ਅਤੇ ਉੱਥੇ ਉਹ ਬੈਠੇ ਅਤੇ ਉਨ੍ਹਾਂ ਨੇ ਕੀ ਮੇਰਾ ਧਿਆਨ ਨਹੀਂ ਸੀਗਾ ਮੇਰਾ ਧਿਆਨ ਤਾਂ ਸਿਰਫ਼ ਸੈਰ ਕਰਨ ਦੇ ਵਿੱਚ ਸੀਗਾ ਮੈਨੂੰ ਨਹੀਂ ਪਤਾ ਸੀ ਉਨ੍ਹਾਂ ਦੇ ਦਿਮਾਗ ਵਿੱਚ ਕੀ ਸ਼ੈਤਾਨੀ ਚੱਲ ਰਹੀ ਹੈ ਅਤੇ ਉਨ੍ਹਾਂ ਨੇ ਕੀ ਕੀਤਾ ਕੁੱਤਿਆਂ ਨੂੰ ਉਨ੍ਹਾਂ ਨੇ ਛੇੜ ਤਾ ਜਾਂ ਉਨ੍ਹਾਂ 'ਤੇ ਕੋਈ ਡਲਾ ਮਾਰ ਤਾ ਮੇਰਾ ਧਿਆਨ ਨਹੀਂ ਸੀ ਆਪ ਤਾਂ ਉਹ ਭੱਜ ਲਏ ਅਤੇ ਮੇਰਾ ਧਿਆਨ ਨਹੀਂ ਸੀਗਾ ਅਤੇ ਜਦੋਂ ਕੁੱਤੇ ਕੋਲ ਆਗੇ ਅਤੇ ਜਦੋਂ ਹੀ ਕੋਲ ਆਏ ਕਿਉਂਕਿ ਮੈਨੂੰ ਕੁੱਤਿਆਂ ਤੋਂ ਡਰ ਲੱਗਦਾ ਥੋੜ੍ਹਾ ਜਿਹਾ ਕਿਉਂਕਿ ਇੱਕ ਦੋ ਹਾਦਸੇ ਮੇਰੇ ਨਾਲ ਹੋ ਚੁੱਕੇ ਨੇ ਕੁੱਤਿਆਂ ਨਾਲ ਹੀ ਕਿਉਂਕਿ ਤੇ ਇਸ ਤੋਂ ਮੈਨੂੰ ਕੁੱਤਿਆਂ ਤੋਂ ਜ਼ਿਆਦਾ ਡਰ ਲੱਗਦਾ ਸੀ ਇਹ ਗੱਲ ਉਨ੍ਹਾਂ ਨੂੰ ਵੀ ਪਤਾ ਸੀ ਵੀ ਇਹ ਡਰਦਾ ਹੈ ਪਰ ਤੇਰ ਫੇਰ ਵੀ ਉਨ੍ਹਾਂ ਨੇ ਇਹ ਪੰਗਾ ਲਿੱਤਾ ਅਤੇ ਅਸੀਂ ਫੇਰ ਉਦੋਂ ਬਾਅਦ ਕੀ ਦੌੜੇ ਅਸੀਂ ਉਹ ਦੋ ਤਿੰਨ ਕਿਲੋਮੀਟਰ ਦੀ ਜਿਹੜੀ ਦੌੜ ਸੀ ਉਹ ਸਾਡੀ ਪੰਜ ਛੇ ਕਿਲੋਮੀਟਰ ਦੀ ਬਣਗੀ ਅਤੇ ਚਲੋ ਉਸ ਦਿਨ ਇਹ ਵੀ ਵਧੀਆ ਸੀ ਗਾ ਸੀ ਕੈਲਰੀਸ ਆਪਣੀਆਂ ਜਿਆਦਾ ਬਰਨ ਕੀਤੀਆਂ ਅਤੇ ਇਹ ਸਾਡਾ ਇੱਕ ਫਨੀ ਕਿੱਸਾ ਸੀਗਾ ਮੈਨੂੰ ਹਮੇਸ਼ਾ ਆਪਣੇ ਦੋਸਤਾਂ ਨਾਲ ਯਾਦ ਯਾਦ ਰਹਿੰਦਾ ਹੈ ਗਾ ਅਤੇ ਯਾਦ ਰਹੇਗਾ ਭਾਵੇਂ ਅੱਜ ਅਸੀਂ ਇਕੱਠੇ ਨਹੀਂ ਹੈਗੇ ਅਸੀਂ ਅਲੱਗ ਹੋ ਚੁੱਕੇ ਹਾਂ ਕਿਉਂਕਿ ਮਿੱਤਰ ਅਆ ਮਿਲਦੇ ਵਿਛੜਦੇ ਰਹਿੰਦੇ ਨੇ ਕਈ ਬਾਹਰ ਚਲੇ ਗਏ ਕਈ ਆਪਣੇ ਕੰਮਾਂ ਕਾਰਾਂ 'ਚ ਵਿਅਸਤ ਹੋ ਗਏ ਪਰ ਇਹ ਜਿਹੜਾ ਕਿੱਸਾ ਗਾ ਇਹ ਮੈਨੂੰ ਇਹ ਹਮੇਸ਼ਾ ਮੇਰੇ ਦਿਲ ਦੇ ਕਰੀਬ ਰਹੂਗਾ ਕਿ ਉਸ ਦਿਨ ਅਸੀਂ ਇੰਨਾਂ ਫਨ ਕੀਤਾ ਅਸੀਂ ਸੈਰ ਵੀ ਕੀਤੀ ਅਸੀਂ ਇੰਜੋਆਏ ਵੀ ਕੀਤਾ ਪਰ ਉਨ੍ਹਾਂ ਨੂੰ ਆਏਂ ਨਹੀਂ ਕਰਨਾ ਚਾਹੀਦਾ ਸੀਗਾ ਇਹਦਾ ਮੈਨੂੰ ਹਮੇਸ਼ਾ ਕਿਉਂਕਿ ਜੇ ਕੁੱਤਾ ਵੱਡ ਲੈਂਦਾ ਫਿਰ ਚੌਦਾਂ ਟੀਕੇ ਲੱਗਣੇ ਸੀਗੇ ਜਿਸ ਦਾ ਡਰ ਮੈਨੂੰ ਹਮੇਸ਼ਾ ਹੀ ਬਣਿਆ ਰਹਿੰਦਾ ਐ